ਲੈਪਟੋਪ ਦੇ ਨੁਕਸਾਨ ਓਵਰ ਹੀਟਿੰਗ ਲੈਪਟੋਪ ਗਰਮ ਹੋ ਸਕਦੇ ਹਨ ਜੇ ਵਧੇ ਹੋਏ ਸਮੇਂ ਲਈ ਵਰਤੇ ਜਾਂਦੇ ਹਨ ਜੇ ਨਰਮ ਸਤਹਿ 'ਤੇ ਰੱਖਿਆ ਜਾਂਦਾ ਹੈ ਜੋ ਹਵਾ ਅਤੇ ਭਾਂਡਿਆਂ ਨੂੰ ਰੋਕਦਾ ਹੈ ਓਵਰ ਹੀਟਿੰਗ ਪ੍ਰਦਰਸ਼ਕ ਦੇ ਮੁੱਦਿਆਂ ਦਾ ਕਾਰਨ ਬਣ ਸਕਦੀ ਹੈ ਅਤੇ ਲੈਪਟੋਪ ਦੇ ਭਾਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਤੁਹਾਨੂੰ ਇਸ ਨੂੰ ਇੱਕ ਪਾਸੇ ਰੱਖਣ ਅਤੇ ਫਿਰ ਇਸਦੀ ਵਰਤੋਂ ਕਰਨ ਦੀ ਜ਼ਰੂਰਤ ਹੈ ਇਹ ਤੁਹਾਡੇ ਕੰਮ ਵਿੱਚ ਦੇਰੀ ਕਰਦਾ ਹੈ ਬੈਟਰੀ ਲਾਈਫ ਡੀਗਰੇਡੇਸ਼ਨ ਲੈਪਟੋਪ ਦੀ ਬੈਟਰੀ ਦੀ ਜ਼ਿੰਦਗੀ ਸਮੇਂ ਦੇ ਨਾਲ਼ ਵਿਗੜ ਜਾਂਦੀ ਹੈ ਮੁੱਖ ਤੌਰ 'ਤੇ ਜੇ ਇਹ ਅਕਸਰ ਵਰਤੀ ਜਾਂਦੀ ਹੈ ਜਾਂ ਸਹੀ ਤਰ੍ਹਾਂ ਬਣਾਈ ਜਾਂਦੀ ਹੈ ਇਹ ਇੱਕ ਨੁਕਸਾਨ ਹੋ ਸਕਦਾ ਹੈ ਜੇ ਤੁਸੀਂ ਆਪਣੇ ਲੈਪਟੋਪ ਦੀ